ਪੰਜਾਬੀ ਲੋਕਾਂ ਦੀ ਜਾਣ ਪਛਾਣ ਉਹਨਾਂ ਦੇ ਬੋਲਣ ਤੋਂ ਹੁੰਦੀ ਹੈ ਉਹਨਾਂ ਦੇ ਬੋਲਣ ਵਿੱਚ ਬਹੁਤ ਮਿਠਾਸ ਹੁੰਦੀ ਹੈ ਤਾਂ ਹੀ ਉਹ ਹਰ ਇੱਕ ਲਈ ਖਿੱਚ ਦਾ ਕੇਂਦਰ ਬਣੇ ਹੁੰਦੇ ਹਨ ਹਰ ਇੱਕ ਨੂੰ ਖਿੜੇ ਮਿੱਠੇ ਮਿਲਦੇ ਹਨ ਸਭ ਨੂੰ ਆਦਰ ਸਤਿਕਾਰ ਨਾਲ ਬੁਲਾਉਂਦੇ ਹਨ ਅਤੇ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਦੇ ਹਨ ਪੰਜਾਬੀ ਲੋਕ ਹਰ ਇੱਕ ਨਾਲ ਖੜ੍ਹੇ ਹੁੰਦੇ ਹਨ ਭਾਵੇਂ ਖੁਸ਼ੀ ਦਾ ਮੌਕਾ ਹੋਵੇ ਭਾਵੇਂ ਗਮੀਂ ਦਾ ਮੌਕਾ ਹੋਵੇ ਉਹ ਹਰ ਇੱਕ ਨਾਲ ਖੜ੍ਹੇ ਰਹਿੰਦੇ ਹਨ ਪਿੱਛੇ ਨਹੀਂ ਕਦੇ ਵੀ ਨਹੀਂ ਹਟਦੇ ਪੰਜਾਬੀ ਪੰਜਾਬੀ ਭਾਸ਼ਾ ਨੂੰ ਵਧੀਆ ਬੋਲਣ ਵਾਸਤੇ ਵੱਖਰੇ ਵੱਖਰੇ ਅਖਾਣਾਂ ਦੀ ਵਰਤੋਂ ਕਰਦੇ ਹਨ ਜਿਸ ਨਾਲ ਭਾਸ਼ਾ ਹੋਰ ਵੀ ਵਧੀਆ ਲੱਗਦੀ ਹੈ ਅਸੀਂ ਪੰਜਾਬੀ ਵਿੱਚ ਪੰਜਾਬ ਵਿੱਚ ਰਹਿੰਦੇ ਹੋਏ ਵੀ ਪੰਜਾਬੀ ਹਾਂ ਮੈਨੂੰ ਆਪਣੀ ਪੰਜਾਬੀ ਭਾਸ਼ਾ 'ਤੇ ਮਾਣ ਹੈ